ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਕਿ ਉਹਨਾਂ ਤਸਵੀਰਾਂ ਬਾਰੇ ਦੱਸੋ ਜੋ ਤੁਸੀਂ ਹੁਣ ਤੱਕ ਖਿੱਚੀਆਂ ਹਨ ਤੁਸੀਂ ਆਮ ਤੌਰ 'ਤੇ ਕਿਹੋ ਜਿਹੀਆਂ ਤਸਵੀਰਾਂ ਖਿੱਚਦੇ ਹੋ ਮੈਂ ਸਭ ਤੋਂ ਪਹਿਲਾਂ ਮੈਂ ਦੱਸਣਾ ਵੀ ਮੈਂ ਸਭ ਤੋਂ ਪਹਿਲਾਂ ਤਸਵੀਰਾਂ ਖਿੱਚਦਾ ਸੀ ਜਿਵੇਂ ਕਿ ਕੋਈ ਲੇਡੀ ਜਾਂ ਬਜ਼ੁਰਗ ਨਲਕੇ ਤੋਂ ਪਾਣੀ ਭਰ ਰਿਹਾ ਜਾਂ ਖੂਹਾਂ 'ਚੋਂ ਉਹ ਖਿੱਚ ਰਿਹਾ ਜਿਵੇਂ ਪੰਜਾਬੀ ਸੱਭਿਆਚਾਰਕ ਜਾਂ ਆਪਣੇ ਸੱਭਿਆਚਾਰ ਨੂੰ ਦਰਸਾਉਂਦੀ ਹੋਵੇ ਉਹੋ ਜਿਹੀਆ ਹੀ ਤਸਵੀਰਾਂ ਅਸੀਂ ਮੈਂ ਜ਼ਿਆਦਾਤਰ ਖਿੱਚ ਕੇ ਰਾਜ਼ੀ ਹਾਂ ਜੋ ਆਮ ਲੋਕਾਂ ਨੂੰ ਵੀ ਬਹੁਤ ਸੋਹਣੀਆਂ ਲੱਗਦੀਆਂ ਹਨ ਅਤੇ ਇਹ ਤਸਵੀਰਾਂ ਖਿੱਚਣ ਦੇ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਦਰਸਾਉਂਦਾ ਹੋਵੇ ਜੋ ਚੀਜ਼ ਉਹ ਮੇਰੇ ਮਨ ਨੂੰ ਬਹੁਤ ਭਾਉਂਦੀ ਹੈ ਅਤੇ ਮੈਂ ਇਹ ਤਸਵੀਰਾਂ ਜ਼ਿਆਦਾਤਰ ਜਿਵੇਂ ਕਿਸੇ ਪਿੰਡਾਂ ਦੇ ਵਿੱਚ ਜਾ ਕੇ ਹੀ ਖਿੱਚਦਾ ਅਤੇ ਉਹਨਾਂ ਨੂੰ ਲੋਕਾਂ ਲੋਕਾਂ ਦੇ ਅੱਗੇ ਤਸਵੀਰਾਂ ਦੇ ਰਾਹੀਂ ਮੈਂ ਪੇਸ਼ ਕਰਦਾ ਵੀ ਇਹੋ ਜਿਹੀਆਂ ਫੋਟੋਆਂ ਜਾਂ ਸੱਭਿਆਚਾਰ ਆਪਣੇ ਪੰਜਾਬ ਦਾ ਹੈ